ਮੇਰੇ ਸਹੁਰੇ ਪਰਿਵਾਰ ਦੇ ਮੈਂਬਰ ਮੇਰੇ ਦੁਆਰਾ ਬਣਾਇਆ ਹੋਇਆ ਖਾਣਾ ਬਹੁਤ ਪਸੰਦ ਕਰਦੇ ਹਨ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਬਣਾਉਣੀਆਂ ਆਉਂਦੀਆਂ ਹਨ ਜਿਵੇਂ ਕਹਿੰਦੇ ਹਨ ਨਾ ਦਿਲ ਦਾ ਰਸਤਾ ਮੂੰਹ ਦੇ ਰਾਹੀਂ ਹੀ ਸ਼ੁਰੂ ਹੁੰਦਾ ਹੈ ਵਧੀਆ ਖਾਣਾ ਬਣਾ ਕੇ ਅਸੀਂ ਸਾਰਿਆਂ ਦਾ ਦਿਲ ਜਿੱਤ ਸਕਦੇ ਹਾਂ ਵਧੀਆ ਚੀਜ਼ਾਂ ਖਾਣ ਨਾਲ ਵੀ ਸਾਡਾ ਮਨ ਖੁਸ਼ ਹੁੰਦਾ ਹੈ ਰੋਜ਼ ਬਦਲ ਬਦਲ ਕੇ ਨਵੀਆਂ ਚੀਜ਼ਾਂ ਬਣਾਉਣੀਆਂ ਚਾਹੀਦੀਆਂ ਹਨ ਇੱਥੋਂ ਤੱਕ ਜਦੋਂ ਮੇਰੀ ਸਹੇਲੀ ਦੇ ਘਰ ਕਿਟੀ ਪਾਰਟੀ ਹੁੰਦੀ ਹੈ ਜਾਂ ਜਨਮਦਿਨ ਦੀ ਪਾਰਟੀ ਹੁੰਦੀ ਹੈ ਤਾਂ ਉਹ ਖ਼ਾਸ ਮੈਨੂੰ ਹੀ ਆਪਣੇ ਲੈ ਕੇ ਜਾਂਦੀ ਹੈ ਤਾਂ ਮੈਂ ਉਸਦੀ ਚੀਜ਼ਾਂ ਬਣਵਾਉਣ 'ਚ ਮਦਦ ਕਰਦੀ ਹਾਂ ਮੈਨੂੰ ਚੀਜ਼ਾਂ ਦੇ ਕਈ ਔਡਰ ਵੀ ਆਉਂਦੇ ਹਨ ਇਸ ਤੋਂ ਪਹਿਲਾਂ ਮੈਨੂੰ ਚੀਜ਼ਾਂ ਬਾਰੇ ਕੁਝ ਵੀ ਪਤਾ ਨਹੀਂ ਸੀ ਅਸੀਂ ਮਟਰ ਪਨੀਰ ਦੀਆਂ ਸਬਜ਼ੀ ਨੂੰ ਕਈ ਕਿਸਮਾਂ ਨਾਲ ਬਣਾ ਸਕਦੇ ਹਾਂ ਇਸ ਬਾਰੇ ਮੈਨੂੰ ਹੁਣ ਪਤਾ ਲੱਗਿਆ ਹੈ ਇੱਕ ਵਾਰ ਦੀ ਗੱਲ ਹੈ ਮੈਂ ਮਨਚੂਰੀਅਨ ਬਣਾਇਆ ਜਿਸ ਵਿੱਚ ਮੈਂ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਸਬਜ਼ੀਆਂ ਕੱਟ ਕੇ ਪਾਈਆਂ ਅਤੇ ਗੋਲੇ ਵੀ ਬਣਾਏ ਉਸ ਵਿੱਚ ਮੈਂ ਸ਼ਿਮਲਾ ਮਿਰਚ ਗਾਜਰ ਸੋਇਆਬੀਨ ਕੱਦੂਕਸ ਕਰਕੇ ਪਾਏ ਜੋ ਕਿ ਬਹੁਤ ਹੈਲਦੀ ਬਣਿਆ ਸਾਰਿਆਂ ਨੂੰ ਬਹੁਤ ਪਸੰਦ ਕੀਤਾ ਸਾਰਿਆਂ ਨੇ ਉਸਦੀ ਬਹੁਤ ਤਾਰੀਫ਼ ਕੀਤੀ ਮੈਂ ਇਸ ਤੋਂ ਇਲਾਵਾ ਮੈਨੂੰ ਸ਼ਾਕਾਹਾਰੀ ਮਾਸਾਹਾਰੀ ਕਾਫ਼ੀ ਕਿਸਮ ਦੇ ਭੋਜਨ ਬਣਾਉਣੇ ਆਉਂਦੇ ਹਨ ਮੈਨੂੰ ਜਾਮੁਨ ਪੀਜ਼ਾ ਸਪਰਿੰਗ ਰੋਲ ਇਡਲੀ ਡੋਸਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਮੈਂ ਬਣਾ ਲੈਂਦੀ ਹਾਂ ਸਾਰੇ ਇਸ ਨੂੰ ਬਹੁਤ ਪਸੰਦ ਕਰਦੇ ਹਨ ਸਾਰੇ ਮੇਰੇ ਖਾਣੇ ਦੀ ਬਹੁਤ ਤਾਰੀਫ਼ ਕਰਦੇ ਹਨ ਜਦੋਂ ਮੈਨੂੰ ਉਸ ਬ ਰੈਸਪੀ ਬਾਰੇ ਪੁੱਛਦੇ ਹਨ ਤਾਂ ਮੈਂ ਉਸਨੂੰ ਬਹੁਤ ਪਿਆਰ ਨਾਲ ਉਹਨਾਂ ਨੂੰ ਸਮਝਾਉਂਦੀ ਹਾਂ ਤਾਂ ਉਹ ਘਰ ਜਾ ਕੇ ਟ੍ਰਾਈ ਕਰਦੇ ਹਨ ਤਾਂ ਮੈਨੂੰ ਯਾਦ ਕਰਦੇ ਹਨ ਥੈਂਕ ਯੂ